ਹੈਲੋਂ ਮੈਂ ਨੀਲਮ ਮੈਂ ਤੁਹਾਡੇ ਰੈਸਟੋਰੈਂਟ ਤੋਂ ਖਾਣਾ ਔਰਡਰ ਕੀਤਾ ਸੀ ਜੋ ਹਜੇ ਤੱਕ ਨਹੀਂ ਪਹੁੰਚ ਸਕਿਆ ਮੈਂ ਕੀ ਮੈਂ ਤੁਹਾਡੇ ਰੈਸਟੋਰੈਂਟ ਤੋਂ ਖਾਣੇ ਦੇ ਦੇਰ ਨਾਲ ਆਉਣ ਦਾ ਕਾਰਨ ਜਾਣ ਸਕਦੀ ਹਾਂ ਮੈਂ ਤੁਹਾਡੀ ਉਡੀਕ ਕਰ ਰਹੀ ਹਾਂ ਕਿਰਪਾ ਕਰਕੇ ਮੈਨੂੰ ਕਾਰਨ ਦੱਸਿਆ ਜਾਵੇ